ਮੈਂ ਵਿਜੇ ਗੁਰਦਾਸਪੁਰ ਜ਼ਿਲ੍ਹੇ ਦਾ ਵਾਸੀ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਜੋ ਕਿ ਸਾਡੇ ਪੰਜਾਬ ਵਿੱਚ ਬੋਲੀ ਜਾਂਦੀ ਹੈ ਪੰਜਾਬ ਦੇ ਲੋਕ ਪੰਜਾਬੀ ਭਾਸ਼ਾ ਨੂੰ ਬੜਾ ਹੀ ਵਧੀਆ ਦਰਜਾ ਦਿੰਦੇ ਹਨ ਅੱਜ ਥਾਂ ਥਾਂ ਤੇ ਪੰਜਾਬੀ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਦਾ ਨਾਰਾ ਚਲਦਾ ਆ ਰਿਹਾ ਹੈ ਸਰਕਾਰੀ ਦਫਤਰਾਂ ਵਿੱਚ ਵੀ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਸਾਰੇ ਅਦਾਰਿਆਂ ਸਾਰੇ ਇਹ ਦੁਕਾਨਦਾਰਾਂ ਸਾਰੇ ਹੀ ਵੱਡੇ ਵੱਡੇ ਦਫਤਰਾਂ ਲਈ ਵੀ ਪੰਜਾਬੀ ਲਾਜ਼ਮੀ ਹੈ ਸਾਰੇ ਦਫਤਰਾਂ ਦਾ ਨਾਂ ਪੰਜਾਬੀ ਵਿੱਚ ਲਿਖਿਆ ਨਜ਼ਰ ਆਉਂਦਾ ਹੈ ਅੱਜ ਸਰਕਾਰ ਨੇ ਇਹ ਜਰੂਰੀ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਪੰਜਾਬੀ ਵਿੱਚ ਲਿਖਿਆ ਨਾ ਹੀ ਕਬੂਲਿਆ ਜਾਵੇਗਾ ਉਸ ਤੋਂ ਇਲਾਵਾ ਜਿਹੜੀ ਮਰਜ਼ੀ ਭਾਸ਼ਾ ਲਿਖੋ ਪਰ ਪੰਜਾਬੀ ਜਰੂਰੀ ਹੋਣੀ ਚਾਹੀਦੀ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਸਾਡੇ ਸਥਾਨਕ ਆਰਥਿਕਤਾ ਵਿੱਚ ਪੰਜਾਬੀ ਦੀ ਵਰਤੋਂ ਬੜੀ ਹੀ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਜੇਕਰ ਅਸੀਂ ਪੰਜਾਬੀ ਭਾਸ਼ਾ ਲਈ ਵਪਾਰ ਵਣਜ ਦੀ ਗੱਲ ਕਰੀਏ ਤਾਂ ਇਹ ਇਸ ਲਈ ਬੜੀ ਹੀ ਵਧੀਆ ਸਿੱਧ ਹੁੰਦੀ ਹੈ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਸਾਡੀ ਸਥਾਨ ਦੀ ਭਾਸ਼ਾ ਹੈ ਪੰਜਾਬੀ ਸਾਡੀ ਆਪਣੀ ਮਾਂ ਬੋਲੀ ਹੈ ਜਿਸ ਨੂੰ ਬੋਲ ਕੇ ਅਸੀਂ ਸਾਰਾ ਹੀ ਵਪਾਰ ਸਾਰੇ ਹੀ ਕੰਮ ਧੰਦੇ ਜਾਂ ਸਾਰੇ ਹੀ ਆਪਣੇ ਇਫ ਇਹ ਬਹੂ ਗਿਣਤੀ ਦੇ ਕੰਮ ਜਿੱਦਾਂ ਪੜ੍ਹਾਈ ਦੇ ਲਿਖਾਈ ਦੇ ਇਹ ਕੰਮ ਧੰਦ ਖੇਤੀ ਦੇ ਜਾਂ ਹੋਰ ਵਣਜ ਦੇ ਅਸੀਂ ਇਸ ਦੇ ਅਧਾਰ ਤੇ ਹੀ ਕਰ ਸਕਦੇ ਹਾਂ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਸਾਰੇ ਹੀ ਇਸ ਨੂੰ ਅਪਣਾਈਏ ਤੇ ਇਹ ਇੱਕ ਬੜੀ ਵਧੀਆ ਭਾਸ਼ਾ ਹੈ ਧੰਨਵਾਦ